ਹੈਲੋ ਸਰ ਪੀ ਆਰ ਟੀ ਸੀ ਸਰਵਿਸ ਬੱਸ ਸਟੈਂਡ ਤੋਂ ਗੱਲ ਕਰਦੇ ਪਏ ਸਰ ਸਰ ਮੈਂ ਅਰਸ਼ਦੀਪ ਸਿੰਘ ਬਟਾਲੇ ਤੋਂ ਗੱਲ ਕਰਦਾ ਪਿਆ ਹੈਗਾ ਵਾਂ ਸਰ ਮੈਂ ਪੁੱਛਣਾ ਸੀ ਤੁਹਾਨੂੰ ਕਿ ਇੱਥੋਂ ਹਿਮਾਚਲ ਜਾਣ ਵਾਲੀ ਲਾਸਟ ਬੱਸ ਕਿੰਨੇ ਵਜੇ ਜਾਂਦੀ ਹੈਗੀ ਹੈ ਸਰ ਮੈਂ ਨਾ ਜਾਣਾ ਹੈਗਾ ਮੇਰੇ ਨਾਲ ਇੱਥੇ ਕੁਛ ਫੈਮਿਲੀ ਮੈਂਬਰਸ ਹੈਗੇ ਆ ਅਤੇ ਨਾਲੇ ਸਰ ਮੈਂ ਪੁੱਛਣਾ ਸੀ ਕੀ ਸਰਵਿਸ ਹੈਗੀ ਆ ਉਸ ਦੀ ਬੱਸ ਦੀ ਕਿਉਂਕਿ ਸਰ ਸਾਨੂੰ ਕੋਈ ਪ੍ਰੋਬਲਮ ਨਾ ਆਏ ਕਿਉਂਕਿ ਕੁਝ ਬੱਸਾਂ ਹੁੰਦੀਆਂ ਸਰ ਜਿਹਨਾਂ ਦੇ ਸਟੋਪ ਬਹੁਤ ਜ਼ਿਆਦਾ ਹੁੰਦੇ ਆ ਮੈਂ ਡਾਇਰੈਕਟ ਡਾਇਰੈਕਟ ਚਾਹੀਦੀ ਹੈਗੀ ਆ ਸਰ ਬਸ ਕੋਈ ਕੋਈ ਹੈਗੀ ਆ ਸਰ ਪਲੀਜ਼ ਮੈਨੂੰ ਕਫਰਮ ਕਰਕੇ ਦੱਸ ਦਿਓ ਕਿਉਂਕਿ ਮੈਂ ਨਾ ਫਸਟ ਟਾਈਮ ਜਾ ਰਿਹਾ ਪਹਿਲਾਂ ਮੈਂ ਕਦੀ ਬਸ ਦਾ ਸਰ ਸਫਰ ਨਹੀਂ ਕੀਤਾ ਹੈਗਾ ਕਿਉਂਕਿ ਇਸ ਵਿੱਚ ਧੱਕੇ ਧੁੱਕੇ ਬਹੁਤ ਪੈਂਦੇ ਹੈਗੇ ਬਸ 'ਚ ਤਾਂ ਮੈ ਕਿਹਾ ਇਕ ਵਾਰੀ ਕਨਫਰਮ ਹੋ ਜਾਵੇ ਸਰ ਪਲੀਸ ਸਰ ਮੈਨੂੰ ਇਕ ਨਾ ਕਫਰਮ ਪੱਕਾ ਕਰਕੇ ਦੱਸ ਦਿਓ ਤਾਂ ਕਿ ਮੈਂ ਸਰ ਖੱਜਲ ਖਰਾਬ ਨਾ ਹੋਵਾਂ ਅਤੇ ਦੇਖ ਲਿਓ ਸਰ ਪਤਾ ਕਰ ਦਿਓ ਚਾਰਜਸ ਕੀ ਹੈਗੇ ਆ ਨਾਲੇ ਏ ਸੀ ਬਸ ਏ ਸੀ ਹੋਵੇ ਕੋਈ ਮਤਲਬ ਐਸ ਐਸੀ ਨਾ ਹੋਵੇ ਕਨਫਰਮ ਕਰਕੇ ਸਰ ਮੈਨੂੰ ਦੱਸ ਦਿਓ ਜ਼ਰੂਰ ਕਿਉਂਕਿ ਬੱਸ ਦਾ ਕੀ ਚਾਰਜਸ ਆ ਕੀ ਹਿਸਾਬ ਕਿਤਾਬ ਹੈਗਾ ਸਰ ਸਾਰਾ ਕੁਝ ਮੈਨੂੰ ਨਾ ਇੱਕ ਵਾਰੀ ਪੱਕਾ ਕਫਰਮ ਕਰ ਦਿਓ ਮੈਨੂੰ ਮੈਂ ਤੁਹਾਡੀ ਕਾਲ ਦੀ ਵੇਟ ਕਰਾਂਗਾ ਸਰ ਮੈਨੂੰ ਜਾਂ ਕੋਲ ਬੈਕ ਕਰ ਦਿਓ ਤੁਸੀਂ ਓਕੇ ਸਰ